ਭੰਗੜਾ ਕਈ ਸਾਲ ਪੁਰਾਣੀ ਮਹੱਤਤਾ ਹੈ ਇਹ ਪੰਜਾਬ ਦੀ ਪੰਜਾਬ ਉੱਨੀ ਸੋ ਸੰਤਾਲੀ ਦੇ ਵਿੱਚ ਦੋ ਧੜਿਆਂ ਦੇ ਵਿੱਚ ਵੰਡਿਆ ਗਿਆ ਹੈ ਚੜ੍ਹਦਾ ਪੰਜਾਬ ਭਾਰਤ ਦੇ ਵਿੱਚ ਆ ਗਿਆ ਅਤੇ ਲਹਿੰਦਾ ਪੰਜਾਬ ਪਾਕਿਸਤਾਨ ਵੱਲ ਚਲਾ ਗਿਆ ਪਾਕਿਸਤਾਨ ਵੱਲ ਜੋ ਪੰਜਾਬ ਹੈ ਉੱਥੋਂ ਹੀ ਭੰਗੜੇ ਦੀ ਮਹੱਤਤਾ ਸ਼ੁਰੂ ਹੋਈ ਹੈ ਭੰਗੜੇ ਦਾ ਜਨਮ ਹੋਇਆ ਹੈ ਭੰਗੜੇ ਦੇ ਵਿੱਚ ਪੰਜਾਬੀਆਂ ਦੇ ਦਸ ਜਾਂ ਬਾਰਾਂ ਜਿਹੜਾ ਕੈਂਡੀਡੇਟਸ ਦਾ ਗਰੁੱਪ ਹੁੰਦਾ ਹੈ ਉਸ ਦੇ ਵਿੱਚ ਸਾਰੇ ਰਲ ਕੇ ਭੰਗੜਾ ਪਾਉਂਦੇ ਹਨ ਭੰਗੜਾ ਵਿਸਾਖੀ ਵਾਲੇ ਦਿਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਵਿਸਾਖੀ ਵਾਲੇ ਦਿਨ ਮਨਾਇਆ ਜਾਂਦਾ ਹੈ ਅਤੇ ਬਹੁਤ ਹੀ ਪੰਜਾਬੀ ਉਸ ਦਿਨ ਭੰਗੜਾ ਪਾਉਂਦੇ ਹਨ ਅਤੇ ਉਸ ਸਮੇਂ ਕਣ ਕਣਕ ਦੀ ਫਸਲ ਵੀ ਪੱਕੀ ਹੁੰਦੀ ਹੈ ਵੱਢਣ ਵਾਲੀ ਵਾਢੀ ਸਟਾਰਟ ਹੁੰਦੀ ਹੈ ਅਤੇ ਉਸ ਸਮੇਂ ਵੀ ਭੰਗੜਾ ਪਾਇਆ ਜਾਂਦਾ ਹੈ ਪੰਜਾਬ ਦੇ ਵਿੱਚ ਹੀ ਨਹੀਂ ਪੰਜਾਬੀ ਸੰਸਾਰ ਭਰ ਧਰਤੀ 'ਤੇ ਵੱਖ ਵੱਖ ਥਾਵਾਂ 'ਤੇ ਫੈਲੇ ਹੋਏ ਹਨ ਅਤੇ ਹਰ ਥਾਂ 'ਤੇ ਜਿੱਥੇ ਪੰਜਾਬੀ ਰਹਿੰਦੇ ਹਨ ਉੱਥੇ ਭੰਗੜੇ ਦੀ ਮਹੱਤਤਾ ਬਹੁਤ ਹੀ ਪ੍ਰਫੁੱਲਿਤ ਅਤੇ ਪ੍ਰਸਥਿਤੀਆਂ ਦੇ ਦੌਰ ਤੋਂ ਗੁਜਰ ਰਹੀ ਹੈ ਭੰਗੜਾ ਇੱਕ ਪੰਜਾਬੀਆਂ ਦਾ ਗਹਿਣਾ ਹੈ ਜਿਵੇਂ ਕਿ ਮੁਟਿਆਰਾਂ ਦਾ ਗਿੱਧਾ ਹੈ ਉਸੇ ਤਰ੍ਹਾਂ ਹੀ ਪੰਜਾਬੀਆਂ ਦਾ ਭੰਗੜਾ ਹੈ ਅਤੇ ਭੰਗੜੇ ਦੇ ਨਾਲ ਕਈ ਕਈ ਥਾਵਾਂ 'ਤੇ 'ਤੇ ਮਹੱਤਤਾ ਮਿਲਦੀ ਹੈ ਭੰਗੜਾ ਭੰਗੜੇ ਨੂੰ ਕਈ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਭੰਗੜਾ ਮਲਵਈ ਗਿੱਧਾ ਅਤੇ ਭੰਗੜਚੀ ਅਤੇ ਘੱਗਰ ਪਾਉਣਾ ਅਤੇ ਹੋਰ ਕਈ ਮਹੱਤਤਾ ਦਿੱਤੀਆਂ ਜਾਂਦੀਆਂ ਹਨ ਭੰਗੜੇ ਦੇ ਕਈ ਕਈ ਨਾਮ ਦਿੱਤੇ ਜਾਂਦੇ ਹਨ ਵੱਖ ਵੱਖ ਥਾਵਾਂ ਅਤੇ ਵੱਖ ਵੱਖ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਭੰਗੜੇ ਦੇ ਵੱਖ ਵੱਖ ਨਾਮ ਹਨ ਭੰਗੜਾ ਪੰਜਾਬੀਆਂ ਦੀ ਇੱਕ ਅਹਿਮ ਭੂਮਿਕਾ ਹੈ ਭੰਗੜਾ ਪੰਜਾਬੀ ਆਪਣੇ ਪੁੱਤਰ ਦੇ ਵਿਆਹ ਧੀ ਦੇ ਵਿਆਹ 'ਤੇ ਭੰਗੜਾ ਪਾਉਂਦੇ ਹਨ ਅਤੇ ਪੁੱਤ ਦੇ ਪੋਤੇ ਹੋਣ 'ਤੇ ਜਵਾਕ ਬੱਚਾ ਹੋਣ 'ਤੇ ਭੰਗੜਾ ਪਾਉਂਦੇ ਹਨ ਉਹ ਇੱਕ ਬਹੁਤ ਹੀ ਜ਼ਿਆਦਾ ਖੁਸ਼ੀ ਦੇ ਮਾਹੌਲ ਵਿੱਚ ਭੰਗੜੇ ਪਾਏ ਜਾਂਦੇ ਹਨ